ਮੇਰੇ ਲਈ ਸਭ ਤੋਂ ਚੁਣੌਤੀਪੂਰਨ ਵਿਅੰਜਨ ਵਿਅੰਜਨ ਹੈਗਾ ਜੋ ਉਹ ਸੀਗਾ ਸ਼ਾਹੀ ਪਨੀਰ ਮੈਂ ਉਸ ਨੂੰ ਬਣਾਉਣ ਦੀ ਕੋਸ਼ਿਸ਼ ਪਹਿਲਾਂ ਪਹਿਲਾਂ ਕੀਤੀ ਫਿਰ ਮੈਨੂੰ ਬਣਿਆ ਨਹੀਂ ਮੇਰੇ ਤੋਂ ਮੈਂ ਉਹਦਾ ਅਭਿਆਸ ਕਰਦੀ ਰਹੀ ਕਰਦੀ ਰਹੀ ਕਰਦੀ ਰਹੀ ਫਿਰ ਮੈਂ ਬਹੁਤ ਵਧੀਆ ਬਣਾਇਆ ਹੁਣ ਮੈਨੂੰ ਸਾਰੇ ਵਿਅੰਜਨ ਬਣਾਉਣੇ ਆਉਂਦੇ ਨੇ ਸਾਰਾ ਕੁਝ ਬਣਾ ਲੈਂਦੀਆਂ ਆਂ ਆਪਣੇ ਬੱਚਿਆਂ ਨੂੰ ਬਣਾ ਕੇ ਖੁਆ ਲੈਂਦੀ ਹਾਂ ਚਾਈਨਜ਼ ਵੀ ਇੰਡੀਅਨ ਵੀ ਸਾਰਾ ਕੁਝ ਬਣਾ ਕੇ ਆਪਣੇ ਬੱਚਿਆਂ ਨੂੰ ਦੇ ਦਿੰਦੀ ਹਾਂ